ਖੇਡਾਂ ਦੇ ਸਬੰਧਤ ਹਿੰਸਾ ਦੇ ਮੁੱਦੇ ਬਹੁਤ ਘੱਟ ਨਜ਼ਰ ਆਉਂਦੇ ਹੈ ਕਿਉਂਕਿ ਖਿਡਾਰੀ ਬਹੁਤ ਸੁਲਝੇ ਹੋਏ ਹੁੰਦੇ ਆ ਬਹੁਤ ਮਿਹਨਤ ਕੀਤੀ ਹੁੰਦੀ ਉਹਨਾਂ ਉਹ ਹਿੰਸਾ ਤੋਂ ਦੂਰ ਹੀ ਰਹਿਣਾ ਜਿਹੜਾ ਪਸੰਦ ਕਰਦੇ ਆ ਫਿਰ ਵੀ ਕਿਸੇ ਵਾਰੀ ਭਲਵਾਨੀ ਕਰਦਿਆਂ ਜੋਰ ਅਜਮਾਇਸ਼ ਕਰਦਿਆਂ ਗਰਮਾ ਗਰਮੀ ਹੋ ਜਾਂਦੀ ਆਪਸ ਵਿੱਚ ਉਹਨਾਂ ਦਾ ਕੋਈ ਮਤਭੇਦ ਹੋ ਜਾਂਦਾ ਲੜਾਈ ਹੋ ਜਾਂਦੀ ਆ ਅਤੇ ਉੱਥੇ ਮੋਹਤਬਾਰ ਬੰਦੇ ਬੈਠੇ ਜਾਂ ਪੰਚਾਇਤ ਜੋ ਉੱਥੇ ਬੈਠੀ ਹੁੰਦੀ ਹੈ ਪਿੰਡਾਂ ਦੇ ਵਿੱਚ ਉਹ ਉਸ ਦਾ ਫੈਸਲਾ ਕਰਾ ਦਿੰਦੇ ਆ ਉਹਨਾਂ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਲਈ ਪ੍ਰੇਰਿਤ ਕਰਦੇ ਆ ਅਤੇ ਜੇ ਮਸਲਾ ਉਹਨਾਂ ਤੋਂ ਲੰਘਦਾ ਜਾਪੇ ਤਾਂ ਫਿਰ ਉਹ ਪੁਲਿਸ ਦੀ ਮਦਦ ਲੈਂਦੇ ਆ ਪੁਲਿਸ ਉਹਨਾਂ ਨੂੰ ਥਾਣੇ ਬੁਲਾਉਂਦੀ ਆ ਜਾਂ ਉੱਥੇ ਜੇ ਮਸਲਾ ਹੱਲ ਹੁੰਦਾ ਤਾਂ ਠੀਕ ਆ ਨਹੀਂ ਤਾਂ ਥਾਣੇ ਬੁਲਾ ਕੇ ਉਹਨਾਂ ਤੋਂ ਪੁੱਛ ਗਿੱਛ ਕਰਦੇ ਆ ਪੁੱਛ ਗਿੱਛ ਕਰਕੇ ਉਹਨਾਂ ਦੇ ਮਸਲਿਆਂ ਨੂੰ ਸੁਲਝਾ ਦਿੰਦੇ ਆ